ਹੈਲੋ ਅਸੀਂ ਨਾ ਜੀ ਟੈਕਸੀ ਬੁੱਕ ਕੀਤੀ ਸੀ ਅਤੇ ਉਹ ਪੰਜ ਦਿਨ ਪਹਿਲਾਂ ਟੈਕਸੀ ਬੁੱਕ ਕੀਤੀ ਤੀ ਅਸੀਂ ਨੇ ਜਾਣਾ ਤਾ ਜੀ ਆਪਣਾ ਦਿੱਲੀ ਪਹੁੰਚਣਾ ਸੀ ਟੈਕਸੀ ਦਾ ਨੰਬਰ ਵੀ ਸਾਨੂੰ ਦੇਤਾ ਜੀ ਪਰ ਸਾਤੋਂ ਨੰਬਰ ਗੁੰਮ ਹੋ ਗਿਆ ਜੀ ਸਾਨੂੰ ਪਤਾ ਨਹੀਂ ਹੁਣ ਟੈਕਸੀ ਕਿੱਥੇ ਕੁ ਪਹੁੰਚ ਗਈ ਇਹਦਾ ਫੋਨ ਕਰਕੇ ਤੁਸੀਂ ਪੁੱਛੋ ਵੀ ਸਾਡੀ ਦੋ ਵਜੇ ਦੀ ਫਲੈਟ ਸੀ ਨਹੀਂ ਅਸੀਂ ਟੈਕਸੀ ਕੈਂਸਲ ਕਰਾ ਦਿੰਦੇ ਹਾਂ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਫੋਨ ਕਰਕੇ ਪੁੱਛੋ ਵੀ ਉਰੇ ਸਾਡੇ ਕੋਲ ਪਹੁੰਚਣ ਛੇਤੀ ਤੋਂ ਛੇਤੀ